ਅੱਜ ਕੱਲ੍ਹ ਵਪਾਰ ਵਪਾਰ ਦਾ ਟਰੈਂਡ ਡੇ ਬਾਏ ਡੇ ਚੇਂਜ ਬਦਲ ਹੀ ਰਿਹਾ ਹੈ ਜੋ ਕਿ ਸਾਡੇ ਉਦਯੋਗਿਕ ਪਹਿਲਾਂ ਅਸੀਂ ਦੁਕਾਨ ਹੁੰਦੀਆਂ ਸੀ ਹੁਣ ਅਸੀਂ ਔਨਲਾਈਨ ਸ਼ੋਪਿੰਗ ਜਿਸ ਨਾਲ ਪੇਮੈਂਟ ਦੀ ਟਰਾਂਜੈਕਸ਼ਨ ਆਨਲਾਈਨ ਹੀ ਹੋ ਜਾਂਦੀ ਹੈ ਜਿਵੇਂ ਕੀ ਪੇਟੀਐਮ ਗੂਗਲ ਪੇ ਟਰਾਂਜੈਕਸ਼ਨ ਵੀ ਸੀ ਉਸ ਨੂੰ ਡਿਜੀਟਲ ਪੇਮੈਂਟ ਕਰ ਸਕਦੇ ਹਾਂ ਜਿਸ ਨਾਲ ਹੁਣ ਅਸੀਂ ਪੇਮੈਂਟ ਨੂੰ ਟਰਾਂਜੈਕਸ਼ਨ ਦੇ ਨਾਲ ਕਿਸੇ ਕੋਲੋਂ ਵੀ ਕਿਸੇ ਦੀ ਅਮਾਊਂਟ ਲੈ ਕੇ ਜਿਵੇਂ ਜਮੈਟੋ ਦੇ ਵਿੱਚ ਅਸੀਂ ਬੁਕਿੰਗ ਕਰਾ ਕੇ ਅਸੀਂ ਡਿਜੀਟਲ ਅਸੀਂ ਫੂਡ ਮੰਗਾ ਸਕਦੇ ਹਾਂ ਨਹੀਂ ਤਾਂ ਪਹਿਲਾਂ ਅਸੀਂ ਢਾਬਿਆਂ 'ਤੇ ਜਾ ਕੇ ਰੋਟੀ ਖਾਣੀ ਪੈਂਦੀ ਸੀ ਹੁਣ ਤਾਂ ਜੋ ਵੀ ਚਾਹੀਏ ਅਸੀਂ ਮੰਗਵਾ ਕੇ ਪੇਮੈਂਟ ਔਨਲਾਈਨ ਟਰਾਂਸਫਰ ਕਰ ਦਈਦੀ ਹੈ ਜਿਸ ਨਾਲ ਬਹੁਤ ਹੀ ਸਹੂਲਤਾਂ ਹੋਈਆਂ ਹਨ ਜਿਵੇਂ ਕਿ ਕਿਸੇ ਨੂੰ ਪੇਮੈਂਟ ਭੇਜਣੀ ਹੋਵੇ ਕਿਸੇ ਦੇ ਨੰਬਰ 'ਤੇ ਜੋ ਕਿ ਸਾਡੇ ਸਾਡੇ ਬੈਂਕਾਂ ਦੇ ਨਾਲ ਅਟੈਚਮੈਂਟ ਜਿਹੜੇ ਮੋਬਾਈਲ ਨੰਬਰ 'ਤੇ ਉਹਨਾਂ ਨਾਲ ਗੂਗਲ ਪੇ ਪੇਟੀਐਮ ਪੇ ਵੀ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਪੈਦਾ ਕਰਨਾ ਪੈਂਦਾ ਸੀ ਇੱਕ ਪੇਮੈਂਟ ਤੋਂ ਦੂਜੇ ਸ਼ਹਿਰ ਪੇਮੈਂਟ ਭੇਜਣੀ ਹੋਵੇ ਉਹ ਦਿੱਕਤਾਂ ਦਾ ਡਰਾਫਟ ਬਣਵਾ ਕੇ ਭੇਜਣੀਆਂ ਪੈਂਦੀਆਂ ਸਨ ਜੋ ਕਿ ਹੁਣ ਸਾਨੂੰ ਬਹੁਤ ਹੀ ਇਜ਼ੀ ਹੋ ਗਿਆ ਹੈ ਟਰਾਂਜੈਕਸ਼ਨ ਕਰਨ ਦੇ ਨਾਲ